ਮੇਰੀ ਮਨਪਸੰਦ ਕਿਤਾਬ ਦਾ ਨਾਮ ਹੈ ਜੀਵਨ ਜੋ ਕਿ ਕਵਿਤਾ ਦੇਵੀ ਵੱਲੋਂ ਲਿਖੀ ਗਈ ਹੈ ਮੈਂ ਇਸ ਨੂੰ ਜਦ ਵੀ ਮੇਰਾ ਮਨ ਕਰੇ ਕਿ ਜਦੋਂ ਵੀ ਮੈਂ ਫਰੀ ਹੁੰਦੀ ਹਾਂ ਦਿਨ ਵਿੱਚ ਉਦੋਂ ਹੀ ਮੈਂ ਪੜ੍ਹਨ ਬੈਠ ਜਾਂਦੀ ਹਾਂ ਇਸ ਕਿਤਾਬ ਵਿੱਚ ਬਹੁਤ ਕੁਝ ਇਹੋ ਜਿਹਾ ਹੈ ਲਿਖਿਆ ਹੋਇਆ ਹੈ ਜੋ ਕਿ ਮੈਨੂੰ ਬਹੁਤ ਕੁਝ ਸਿਖਾਉਂਦਾ ਹੈ ਕੁਝ ਕੁ ਲਾਈਨਾਂ ਇਸ ਵਿੱਚ ਇੱਦਾਂ ਦੀਆਂ ਹਨ ਜੋ ਕਿ ਸਾਡੇ ਜੀਵਨ ਵਿੱਚ ਪਹਿਲਾਂ ਤੋਂ ਹੋਈਆਂ ਹੁੰਦੀਆਂ ਹਨ ਜਾਂ ਹੋਣ ਵਾਲੀਆਂ ਹੁੰਦੀਆਂ ਹਨ ਅਸੀਂ ਇਸ ਕਿਤਾਬ ਨੂੰ ਮੈਂ ਪੜ੍ਹ ਕੇ ਬਹੁਤ ਖੁਸ਼ ਹੁੰਦੀ ਹਾਂ ਜਦੋਂ ਵੀ ਮੈਂ ਇਸ ਕਿਤਾਬ ਨੂੰ ਖੋਲ੍ਹਦੀ ਹਾਂ ਤਾਂ ਮੇਰੇ ਚਿਹਰੇ 'ਤੇ ਇੱਕ ਮੁਸਕਾਨ ਹੁੰਦੀ ਹੈ ਅਤੇ ਕੋਈ ਵੀ ਇਹੋ ਜਿਹੀ ਗੱਲ ਮੇਰੇ ਦਿਮਾਗ ਵਿੱਚ ਨਹੀਂ ਆਉਂਦੀ ਜੋ ਕਿ ਮੈਂ ਆਪਣੇ ਨਾਲ ਗਲਤ ਕਰ ਸਕਾਂ ਮੈਨੂੰ ਇਸ ਕਿਤਾਬ ਤੋਂ ਪੋਜੀਟਿਵ ਵਾਈਬ ਮਿਲਦੀ ਹੈ ਇਸ ਕਰਕੇ ਮੈਂ ਇਸਨੂੰ ਫਰੀ ਟਾਈਮ ਪੜ੍ਹਨ ਬੈਠ ਜਾਂਦੀ ਹਾਂ ਅਤੇ ਮੈਂ ਪੜ੍ਹਦੀ ਰਹਿੰਦੀ ਹਾਂ ਪੜ੍ਹਦੀ ਰਹਿੰਦੀ ਹਾਂ ਬਟ ਮੈਨੂੰ ਕੋਈ ਵੀ ਬੋਰਿੰਗ ਚੀਜ਼ ਮਹਿਸੂਸ ਨਹੀਂ ਹੁੰਦੀ ਇਹ ਕਿਤਾਬ ਇੰਨੀ ਪੜ੍ਹਨ ਜੋ ਯੋਗ ਹੈ ਕੀ ਤੁਸੀਂ ਇਸਨੂੰ ਪੜ੍ਹਨ ਪੜ੍ਹਦੇ ਰਹੋਗੇ ਪੜ੍ਹਦੇ ਰਹੋਗੇ ਬਟ ਥੱਕੋਗੇ ਨਹੀਂ ਤਾਂ ਮੈਂ ਸਭ ਨੂੰ ਇਹੀ ਦੱਸਦੀ ਹਾਂ ਕਿ ਜਿੰਨਾਂ ਹੋ ਸਕੇ ਉਨਾਂ ਪੜ੍ਹੋ ਅਤੇ ਸਮਝਣ ਦੀ ਕੋਸ਼ਿਸ਼ ਕਰੋ